ਮੈਂ ਵਿਲਕਪਿਕ ਰਨਿੰਗ ਵਰਕਆਊਟ ਦੀ ਬਹੁਤ ਕੋਸ਼ਿਸ਼ ਕਰਦੀ ਹਾਂ ਜਿਵੇਂ ਕਿ ਟਰਾਇਲ ਰਨਿੰਗ ਅਤੇ ਸਪਰੇਂਡਾਂ ਦੇ ਸੁਪਰਿੰਟ ਲਗਾਉਣ ਲਈ ਥੋੜ੍ਹੀ ਦੂਰੀ ਵਿੱਚ ਬਹੁਤ ਤੇਜ਼ ਭੱਜਣਾ ਹੁੰਦਾ ਹੈ ਇੱਕ ਤਾਂ ਇਹਨਾਂ ਚੀਜ਼ਾਂ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਮੈਂ ਜਦੋਂ ਤੋਂ ਇਹ ਖੇਡਣਾ ਸ਼ੁਰੂ ਕੀਤਾ ਹੈ ਮੇਰਾ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਬਿਮਾਰੀਆਂ ਤੋਂ ਬਹੁਤ ਦੂਰ ਰਹਿੰਦਾ ਹੈ ਇਸ ਦੇ ਨਾਲ ਮੇਰਾ ਆਪਣੇ ਪੜ੍ਹਾਈ ਅਤੇ ਹੋਰ ਕੰਮਾਂ ਵਿੱਚ ਬਹੁਤ ਵਧੀਆ ਦਿਲ ਅਤੇ ਦਿਮਾਗ ਲੱਗਦਾ ਹੈ ਅਤੇ ਆਪਣੀ ਜ਼ਿੰਦਗੀ ਵਿੱਚ ਔਰ ਫੈਂਸਲੇ ਲੈਣ ਵਿੱਚ ਬਹੁਤ ਮਦਦ ਮਿਲਦੀ ਹੈ